ਹਾਂਜੀ ਇੱਕ ਵਾਰੀ ਮੈਂ ਦੋ ਸੂਟ ਮੇਰੇ ਕੋਲ਼ ਸਿਲਨੇ ਆਏ ਸੀ ਅਤੇ ਇੱਕ ਠੀਕ ਬਣ ਗਿਆ ਅਤੇ ਦੂਜੇ ਵਿੱਚ ਥੋੜ੍ਹੀ ਜਿਹੀ ਗਲਤੀ ਹੋ ਗਈ ਅਤੇ ਫਿਰ ਮੈਂ ਬੜਾ ਸੋਚਿਆ ਪਹਿਲਾਂ ਵੀ ਇਹਨੂੰ ਕਿਸ ਤਰ੍ਹਾਂ ਠੀਕ ਕਰਿਆ ਜਾਵੇ ਬੜਾ ਕੁਛ ਸੋਚ ਸੋ ਸੋਚਦੇ ਹੋਏ ਫਿਰ ਮੈਂ ਲੈਸ ਲਿਆਂਦੀ ਅਤੇ ਉਸ ਵਿੱਚ ਥੋੜ੍ਹੀ ਪੈਚ ਲਾ ਕੇ ਕਢਾਈ ਕਰੀ ਅਤੇ ਬਸ ਲੈਸ ਲਾਈ ਅਤੇ ਉਸ ਵਿੱਚ ਜਿੰਨਾ ਵੀ ਕੱਟ ਸੀ ਸਾਰਾ ਠੀਕ ਕਰਿਆ ਅਤੇ ਬਾਅਦ 'ਚ ਫਿਰ ਬੜਾ ਸੋਹਣਾ ਬਣ ਗਿਆ ਪਹਿਲਾਂ ਤਾਂ ਲੱਗਦਾ ਸੀ ਕਿ ਠੀਕ ਨਹੀਂ ਹੋਣਾ ਬੜਾ ਦਿਮਾਗ ਲੜਾਇਆ ਬਹੁਤ ਜ਼ਿਆਦਾ ਮਿਹਨਤ ਕਰੀ ਤਾਂ ਫਿਰ ਉਸਨੂੰ ਜਾ ਕੇ ਕਿਤੇ ਠੀਕ ਕੀਤਾ ਅਤੇ ਬਹੁਤ ਵਧੀਆ ਬਣਾ ਕੇ ਦਿੱਤਾ ਫਿਰ ਮੈਂ ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਿ ਕਿੱਥੇ ਗਲਤੀ ਹੋਈ ਆ ਉਸ ਗਲਤੀ ਨੂੰ ਇਸ ਤਰ੍ਹਾਂ ਠੀਕ ਕਰਤਾ ਕਿ ਕਿਸੇ ਨੂੰ ਵੀ ਪਤਾ ਨਹੀਂ ਚੱਲ ਸਕਦਾ ਸੀ ਕਿ ਸੂਟ ਵਿੱਚ ਕੋਈ ਨੁਕਸ ਵੀ ਪਿਆ ਹੈ